ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਬਹੁਤ ਹੀ ਜ਼ਿਆਦਾ ਸਕੋਲਰਸ਼ਿਪਸ ਸਕੀਮਾਂ ਚੱਲ ਰਹੀਆਂ ਹਨ ਜਿਹਨਾਂ ਦੇ ਕਰਕੇ ਜੋ ਗਰੀਬ ਬੱਚੇ ਹਨ ਜਿਹੜੇ ਕਿ ਸਿੱਖਿਆ ਨਹੀਂ ਪ੍ਰਾਪਤ ਕਰ ਸਕਦੇ ਉਹਨਾਂ ਨੂੰ ਸਕੋਲਸ਼ਿਪ ਰਾਹੀਂ ਪੈਸੇ ਦਿੱਤੇ ਜਾਂਦੇ ਹਨ ਜਿਹਨਾਂ ਕਰਕੇ ਉਹਨਾਂ ਦੀ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਮਦਦ ਹੁੰਦੀ ਹੈ ਇਹ ਸਕੀਮਾਂ ਬਹੁਤ ਹੀ ਜ਼ਿਆਦਾ ਲਾਭਦਾਇਕ ਹਨ ਉਹਨਾਂ ਬੱਚਿਆਂ ਦੇ ਲਈ ਜੋ ਗਰੀਬ ਪਰਿਵਾਰ ਤੋਂ ਆਉਂਦੇ ਹਨ ਇਹ ਬਹੁਤ ਵਧੀਆ ਸਕੀਮ ਹੈ ਸਰਕਾਰ ਦੁਆਰਾ ਜੋ ਕਿ ਹਰ ਇੱਕ ਰਾਜ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਸਿੱਖਿਆ ਬਹੁਤ ਹੀ ਜ਼ਰੂਰੀ ਹੈ ਅੱਜ ਕੱਲ ਦੇ ਇਸ ਦੌਰ ਵਿੱਚ ਪੜ੍ਹਾਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਦੇ ਲਈ ਧੰਨਵਾਦ